ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਦਾਦੀ ਜੀ ਬਸ ਬਸ ਮੈਂ ਵਧੀਆ ਤੁਸੀਂ ਸੁਣਾਓ ਮੈਂ ਤਾਂ ਬਸ ਖੇਡਣ ਚੱਲੀ ਸੀ ਸਕੂਲ ਬੱਸ ਵਧੀਆ ਚਲਿਆ ਜਾਂਦਾ ਤੁਹਾਨੂੰ ਪਤਾ ਅੱਜ ਸਾਡੀ ਪੰਜਾਬੀ ਦੀ ਕਲਾਸ ਵਿੱਚ ਨਾ ਸਾਡੇ ਮੈਡਮ ਨਾ ਉੱਨੀ ਸੌ ਸੰਤਾਲੀ ਦੀ ਜਿਹੜੀ ਵੰਡ ਹੋਈ ਸੀ ਨਾ ਉਹਦੇ ਬਾਰੇ ਗੱਲਾਂ ਦੱਸ ਰਹੇ ਸੀ ਤੁਹਾਡੇ ਨਾਲ ਵੀ ਹੋਈ ਸੀ ਕੋਈ ਦੁਰਘਟਨਾ ਉੱਤੇ ਵਾਪਰੀ ਕੋਈ

ਅੱਛਾ ਅੱਛਾ

ਅੱਛਾ ਅੱਛਾ ਫੇਰ

ਅੱਛਾ ਅੱਛਾ ਤਾਂ ਤੁਸੀਂ ਦੇ ਦਿੱਤੀਆਂ ਅੱਛਾ ਅੱਛਾ

ਅੱਛਾ ਹਾਂਜੀ ਹਾਂਜੀ ਹਾਂਜੀ ਉਹੀ ਅੱਛਾ ਸਾਡੀ ਵੀ ਮੈਡਮ ਸੀਗੀ ਜਿਹੜੀ ਉਹ ਦੱਸਦੀ ਪਈ ਸੀ ਕਿ ਮਤਲਬ ਇੱਦਾਂ ਉਹਨਾਂ ਦੇ ਜਿਹੜੇ ਦਾਦੂ ਅਤੇ ਦਾਦੀ ਦੱਸਦੇ ਪਏ ਸੀ ਉਹਨਾਂ ਨੂੰ ਕਹਾਣੀਆਂ ਬਈ ਇੱਦਾਂ ਹੀ ਉਹਨਾਂ ਦੇ ਨਾਲ ਉਹਨਾਂ ਕੋਲ ਘੋੜੇ ਵਗੈਰਾ ਸੀਗੇ ਪਤਾ ਨਹੀਂ ਉਹ ਕੰਮ ਕਿਹੜਾ ਕਰਦੇ ਸੀ ਅਤੇ ਉਹਨਾਂ ਦੇ ਵੀ ਇੱਦਾਂ ਹੀ ਫੜ ਲਏ ਸੀਗੇ ਅਤੇ ਉਹਨਾਂ ਨੂੰ ਇੱਦਾਂ ਹੀ ਗੁਰਦੁਆਰੇ 'ਚ ਰਹਿਣਾ ਪਿਆ ਕਿੰਨੀ ਦੇਰ ਵਾਸਤੇ ਅੱਛਾ

ਅੱਛਾ ਚਲੋ ਠੀਕ ਹੈ ਦਾਦੀ ਜੀ ਹੁਣ ਮੈਂ ਜਾਵਾਂ ਖੇਡਣ ਅਤੇ ਫਿਰ ਬਾਅਦ 'ਚ ਮੰਮਾ ਨੇ ਬੁਲਾਉਣ ਲੱਗ ਪੈਣਾ ਚਲੋ ਠੀਕ ਹੈ ਹਾਂਜੀ ਹਾਂਜੀ ਹਾਂਜੀ ਉਹੀ ਅਤੇ ਕਿਤਾਬਾਂ 'ਚ ਬੜੇ ਚਲੋ ਠੀਕ ਹੈ ਦਾਦੀ ਜੀ ਓਕੇ ਸਤਿ ਸ੍ਰੀ ਅਕਾਲ ਦਾਦੀ